ਸ਼ਾਸ਼ਤਰੀ ਸੰਗੀਤ ਗਾਉਣ ਦੀ ਇੱਕ ਅਲੱਗ ਪਹਿਚਾਣ ਹੈ ਅਤੇ ਸਮਕਾਲੀ ਗਾਉਣ ਦੀ ਇੱਕ ਅਲੱਗ ਪਹਿਚਾਣ ਇਹ ਬੰਦੇ ਦੀ ਪਸੰਦ ਤੇ ਨਿਰਭਰ ਕਰਦਾ ਹੈ ਕਿ ਉਹ ਸ਼ਾਸਤਰੀ ਸੰਗੀਤ ਗਾਉਣ ਚ ਦਿਲਚਸਪੀ ਰੱਖਦਾ ਹੈ ਜਾਂ ਸਮਕਾਲੀ ਗਾਉਣ ਵਿੱਚ ਮੈਨੂੰ ਤੇ ਦੋਵੇਂ ਹੀ ਪਸੰਦ ਹਨ ਮੁਸ਼ਕਿਲ ਕੀ ਗੱਲ ਹੁੰਦੀ ਹੈ ਮੁਸ਼ਕਿਲ ਤਾਂ ਸਾਰਾ ਕੁਝ ਹੀ ਹੈ ਸ਼ਾਸਤਰੀ ਸੰਗੀਤ ਅਤੇ ਸਮਕਾਲੀ ਦੋਵੇਂ ਆਸਾਨ ਵੀ ਹਨ ਅਤੇ ਮੁਸ਼ਕਲੇ ਵੀ ਹਨ ਇਹ ਬੰਦੇ ਦੀ ਪਸੰਦ ਅਤੇ ਨਾ ਪਸੰਦ ਤੇ ਹੁੰਦਾ ਹੈ ਕਿ ਉਹ ਸ਼ਾਸਤਰੀ ਵਿੱਚ ਵੱਲ ਉਹਦੀ ਪਸੰਦ ਹੈਗੀ ਹ ਜਾਂ ਸਮਕਾਲੀ ਵਿੱਚ ਮੁਸ਼ਕਿਲ ਦੀ ਜੇ ਗੱਲ ਕੀਤੀ ਜਾਵੇ ਮੈਨੂੰ ਸ਼ਾਸਤਰੀ ਸੰਗੀਤ ਗਾਉਣਾ ਥੋੜਾ ਜਿਹਾ ਮੁਸ਼ਕਿਲ ਲੱਗਦਾ ਸਮਕਾਲੀ ਤੋਂ ਸਮਕਾਲੀ ਦੀ ਆਪਣੀ ਪਹਿਚਾਨ ਹੈਗੀ ਹੈ ਸ਼ਾਸਤਰੀ ਥੋੜਾ ਜਾਂ ਮੈਨੂੰ ਲੱਗਦਾ ਹੈ ਕਿ ਔਖਾ ਹੈਗਾ ਪਰ ਐਵੀ ਹੁਣ ਬੰਦੇ ਬੰਦੇ ਤੇ ਨਿਰਭਰ ਕਰਦਾ ਕੀ ਉਹ ਸ਼ਾਸਤਰੀ ਵੱਲ ਜਾਣਾ ਚਾਹੁੰਦਾ ਹੈ ਕਿ ਸਮਕਾਲੀ ਵੱਲ ਜਾਣਾ ਚਾਹੁੰਦੇ ਸਮਕਾਲੀ ਅਤੇ ਸ਼ਾਸਤਰੀ ਦੋਨੋਂ ਹੀ ਬੜੇ ਵਧੀਆ ਗਾਇਕ ਹਨ ਪਸੰਦ ਅਤੇ ਨਾ ਪਸੰਦ ਤੇ ਹੀ ਹੁੰਦਾ ਹੈ ਕੀ ਕਿਸੇ ਨੂੰ ਕਿਹੜਾ ਮੁਸ਼ਕਿਲ ਲੱਗੇ ਸ਼ਾਸਤਰੀ ਸੰਗੀਤ ਬੜਾ ਹੀ ਮਧੁਰ ਤੇ ਵਧੀਆ ਹੁੰਦਾ ਹੈ ਤੇ ਸਮਕਾਲੀ ਦੀ ਵੀ ਅਲੱਗ ਪਹਿਚਾਣ ਹੁੰਦੀ ਹੈ ਧੰਨਵਾਦ